ਭੰਗੜੇ ਦੇ ਕੁਝ ਆਮ ਸਟੈਪ ਮੋਰਾਂ ਵਾਲੀ ਚਾਲ ਮੰਗਰੇਰ ਆਦਿ ਹਨ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਭੰਗੜਾ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਭੰਗੜਾ ਪਾਉਣ ਨਾਲ ਸਾਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਅਤੇ ਇਸ ਨੂੰ ਖਾਸ ਕਰਕੇ ਵਿਸਾਖੀ ਵਾਲੇ ਦਿਨ ਬਹੁਤ ਜੋਸ਼ ਹੋਸ਼ ਨਾਲ ਪਾਇਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਜਦੋਂ ਨੌਜਵਾਨ ਜੋਸ਼ ਨਾਲ ਭੰਗੜਾ ਪਾਉਂਦੇ ਹਨ ਉਦੋਂ ਸਾਰੇ ਲੋਕ ਖੜ੍ਹ ਖੜ੍ਹ ਕੇ ਵੇਖਦੇ ਹਨ ਅਤੇ ਉਹਨਾਂ ਦੇ ਇਸ ਟਰੈਡ ਟਰੈਡ ਨੂੰ ਬਹੁਤ ਸਹਿਲਾਉਂਦੇ ਹਨ